ਕੁਝ ਮੁਸ਼ਕਲ ਪਕਵਾਨ ਜਿਵੇਂ ਡੋਸਾ ਨਿਊਡਲ ਮਨਚੂਰੀਅਨ ਸ਼ਾਹੀ ਪਨੀਰ ਆਦਿ ਹਨ ਇਹਨਾਂ ਨੂੰ ਪਕਾਉਣਾ ਸਿੱਖਣਾ ਮੈਂ ਚਾਹੁੰਦਾ ਹਾਂ ਪਰ ਇਹ ਬਹੁਤ ਜ਼ਿਆਦਾ ਮੁਸ਼ਕਿਲ ਹਨ ਪਕਾਉਣੇ ਕਿਉਂਕਿ ਇਹਨਾਂ ਨੂੰ ਪਕਾਉਣ ਲਈ ਬਹੁਤ ਜ਼ਿਆਦਾ ਮਸਾਲੇ ਦੀ ਲੋੜ ਪੈਂਦੀ ਹੈ ਅਤੇ ਸਮਾਂ ਵੀ ਬਹੁਤ ਲੱਗਦਾ ਹੈ ਇਸ ਕਰਕੇ ਅੱਜ ਕੱਲ੍ਹ ਮੋਡਰਨ ਜ਼ਮਾਨਾ ਹੈ ਸਮਾਂ ਕਿਸੇ ਕੋਲ ਹੈ ਨਹੀਂ ਕੰਮਕਾਰ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੋਣ ਕਰਕੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਅਤੇ ਸਮਾਂ ਬਹੁਤ ਲੱਗਦਾ ਹੈ ਪਕਾਉਣ ਇਸ ਵਾ ਇਹਨਾਂ ਨੂੰ ਪਕਾ ਪਕਾਉਣ ਲਈ ਮੁਸ਼ਕਿਲ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਵਾਦ ਬਣਾਉਣ ਲਈ ਮਸਾਲੇ ਅਤੇ ਹੋਰ ਕੁਝ ਤਰ੍ਹਾਂ ਦੇ ਪਦਾਰਥ ਪੈਂਦੇ ਹਨ ਜਿਹਨਾਂ ਨੂੰ ਸਾਨੂੰ ਨਾਮ ਜਿਹਨਾਂ ਦਾ ਸਾਨੂੰ ਨਾਮ ਵੀ ਨਹੀਂ ਪਤਾ ਉਹ ਮਸਾਲੇ ਪੈਂਦੇ ਆ ਅਤੇ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਇਸ ਕਰਕੇ ਕਿ ਇਹ ਜਿਹੜੇ ਮੈਂ ਪਕਵਾਨ ਦੱਸੇ ਹਨ ਇਹ ਜ਼ਿਆਦਾ ਮੁਸ਼ਕਿਲ ਹਨ ਇਹਨਾਂ ਨੂੰ ਪਕਾਉਣਾ ਅਤੇ ਕਰਨਾ ਹੈ